ਜ਼ਿੰਦਗੀ ਜਿਊਂ ਕੇ ਹੀ ਪਤਾ ਚਲਦਾ ਹੈ ਕਿ ਜਿਹੜੀਆਂ ਚੀਜ਼ਾਂ ਦੇ ਪਿੱਛੇ ਅਸੀਂ ਭੱਜੇ ਰਹਿੰਦੇ ਸੀ ਉਹਨਾਂ ਚੀਜ਼ਾਂ ਦਾ ਕੋਈ ਵੀ ਮਤਲਬ ਨਹੀਂ ਸੀ ਜਿਸ ਤਰ੍ਹਾਂ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਕਿਸੇ ਨੂੰ ਵੀ ਆਪਣੇ ਪਿਆਰ ਦੇ ਨਾਲ ਆਪਣੇ ਪਿਆਰ ਦੇ ਨਾਲ ਕਿਸੇ ਦਾ ਵੀ ਚੰਗਾ ਕਰ ਸਕਦੀ ਕਿਸੇ ਦਿਨ ਦਾ ਵੀ ਸੁਭਾਅ ਬਦਲ ਸਕਦੀ ਹੈ ਪਰ ਉਹ ਕਹਿੰਦੇ ਹਨ ਕਿ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਤੁਸੀਂ ਕਿਸੇ ਦਾ ਕਿੰਨਾ ਵੀ ਕਰਦੇ ਰਹੋ ਪਰ ਅਖੀਰ ਦਾ ਜੋ ਜਿਹਦਾ ਜਿਹੜਾ ਸੁਭਾਅ ਹੈਗਾ ਉਹ ਉਹਦਾ ਉਹੀ ਹੀ ਰਹਿਣਾ ਹੈ ਤੁਸੀਂ ਕਿਸੇ ਨੂੰ ਕਿਸੇ ਹੱਦ ਤੱਕ ਵੀ ਬਦਲ ਨਹੀਂ ਸਕਦੇ ਅਤੇ ਇਹੀ ਚੀਜ਼ ਮੇਰੇ ਨਾਲ ਹੋਈ ਕਿ ਮੈਂ ਲੋਕਾਂ ਨੂੰ ਬਹੁਤ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤਾਂ ਮੇਰਾ ਇਹ ਕੇ ਮਨ ਹੈਗਾ ਕਿ ਜੋ ਕੁਛ ਬਦਲਣਾ ਤੁਸੀਂ ਆਪਦੇ ਆਪ ਦੇ ਵਿੱਚ ਬਦਲਾਅ ਕਰ ਲਉ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਸਮਝੌਤੇ ਕਰਨੇ ਹਨ ਉਹ ਤੁਸੀਂ ਆਪਣੇ 'ਤੇ ਕਰ ਸਕਦੇ ਹੋ ਕਿ ਠੀਕ ਹੈ ਮੈਂ ਅੱਗੇ ਤੋਂ ਇੱ ਅਜਿਹਾ ਨਹੀਂ ਕਰੂੰਗੀ ਪਰ ਤੁਸੀਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਵਾਲੇ ਸਮਝੌਤਿਆਂ 'ਤੇ ਕਾਇਮ ਰਹੇ